ਪੰਜਾਬ ਵਿੱਚ ਯੂਨੀਵਰਸਿਟੀਆਂ ਅਤੇ ਕੋਲਜਾਂ ਵਿੱਚ ਦਾਖਲਾ ਲੈਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੀ ਐਲੀਜੀਬਿਲਿਟੀ ਹੋਣੀ ਚਾਹੀਦੀ ਤੁਸੀਂ ਘੱਟੋ ਘੱਟ ਅਠਾਰਾਂ ਸਾਲ ਤੋਂ ਉੱਤੇ ਹੋਣੇ ਚਾਹੀਦੇ ਹੋ ਅਤੇ ਤੁਹਾਡੇ ਕੋਲ ਦਸਵੀਂ ਅਤੇ ਬਾਰਵੀਂ ਦਾ ਤੁਹਾਡਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਦਸਵੀਂ ਵਿੱਚ ਤੁਸੀਂ ਪੰਜਾਬੀ ਵਿੱਚ ਤੁਹਾਡੇ ਚੰਗੇ ਮਾਰਕਸ ਹੋਣੇ ਚਾਹੀਦੇ ਹਨ ਇਸ ਤੋਂ ਇਲਾਵਾ ਤੁਹਾਡੇ ਆਧਾਰ ਕਾਰਡ ਤੁਹਾਡੇ ਬਾਕੀ ਜਿਹੜੇ ਡਾਕੂਮੈਂਟ ਹੁੰਦੇ ਹਨ ਜਿਵੇਂ ਕਿ ਆਧਾਰ ਕਾਰਡ ਜਾ ਤੁਹਾਡੇ ਫੈਮਲੀ ਦੇ ਅੱਗੋਂ ਆਧਾਰ ਕਾਰਡ ਤੁਹਾਡੇ ਪਾਪਾ ਦਾ ਨਾਮ ਵਿੱਚ ਹੋਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਜੇ ਤੁਸੀਂ ਇੰਜੀਨੀਅਰਿੰਗ ਲਾਈਨ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਜੇ ਈ ਦਾ ਇੱਕ ਪੇਪਰ ਕਲੀਅਰ ਕਰਨਾ ਪਵੇਗਾ ਜਿਹਦੇ ਨਾਲ ਤੁਹਾਨੂੰ ਅੱਗੇ ਸਕੋਲਰਸ਼ਿਪ ਮਿਲੇਗੀ ਇੰਜੀਨੀਅਰਿੰਗ ਲਾਈਨ ਦੇ ਵਿੱਚ ਇਸੇ ਪ੍ਰਕਾਰ ਤੁਹਾਨੂੰ ਜੇ ਮੈਡੀਕਲ ਲਾਈਨ 'ਚ ਜਾਣਾ ਹੈ ਤਾਂ ਤੁਹਾਨੂੰ ਮੈਡੀਕਲ ਲਾਈਨ ਦੇ ਵਿੱਚ ਜਾਣ ਲਈ ਜੇ ਤੁਹਾਨੂੰ ਸਕੋਲਰਸ਼ਿਪ ਦੇ ਥਰੂ ਜਾਣਾ ਹੈ ਤਾਂ ਤੁਹਾਨੂੰ ਉੱਥੇ ਜਾਣ ਲਈ ਇੱਕ ਨੀਟ ਦਾ ਪੇਪਰ ਦੇਣਾ ਪੈਂਦਾ ਹੈ ਜਿਹਦੇ ਵਿੱਚ ਬੱਚਿਆਂ ਨੂੰ ਖੁਦ ਉਹ ਕੋਲਜਿਸ ਅਲੋਟ ਕਰਦੇ ਹਨ ਜਿਹਦੇ ਵਿੱਚ ਤੁਹਾਨੂੰ ਸਕੋਲਰਸ਼ਿਪ ਮਿਲਦੀ ਹੈ ਅਤੇ ਕਈ ਵਾਰ ਤੁਹਾਨੂੰ ਗਵਰਮੈਂਟ ਕੋਲਜਿਸ ਵੀ ਮਿਲ ਜਾਂਦੇ ਹਨ ਇਸ ਤੋਂ ਇਲਾਵਾ ਜੇ ਤੁਸੀਂ ਐਮਟੈਕ ਦਾ ਐਂਟਰਸ ਐਗਜ਼ਾਮ ਦੇਣਾ ਚਾਹੁੰਦੇ ਹੋ ਅਤੇ ਉਹਦੇ ਲਈ ਤੁਸੀਂ ਗੇਟ ਦਾ ਪੇਪਰ ਦੇ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਫਿਰ ਅੱਗੇ ਸਕੋਲਰਸ਼ਿਪ ਮਿਲੇਗੀ ਅਤੇ ਕੁਛ ਬੱਚੇ ਇੱਦਾਂ ਦੇ ਹੁੰਦੇ ਹਨ ਜੋ ਫਾਈਨੈਂਸ਼ੀਅਲੀ ਇੰਨੇ ਨਹੀਂ ਹੁੰਦੇ ਕਿ ਉਹ ਸਾਰੇ ਕੋਰਸਿਸ ਦੀ ਫੀਸ ਦੇ ਸਕਣ ਇਸ ਕਰਕੇ ਜੋ ਇਹ ਪੇਪਰ ਦੇ ਕੇ ਅੱਗੇ ਅੱਗੇ ਵੱਧਦੇ ਹਾਂ ਉਹਨਾਂ ਨੂੰ ਸਕੋਲਰਸ਼ਿਪ ਮਿਲ ਸਕਦੀ ਹੈ ਅਤੇ ਉਸ ਦੇ ਥਰੂ ਉਹ ਬਹੁਤ ਵਧੀਆ ਆਪਣੀ ਪੜ੍ਹਾਈ ਨੂੰ ਅੱਗੇ ਕੈਰੀ ਕਰ ਸਕਦੇ ਹਨ ਇਸ ਤੋਂ ਇਲਾਵਾ ਤੁਹਾਡਾ ਉਹ ਹੀ ਟੈਂਨਥ ਅਤੇ ਟਵੈਲਥ ਦਾ ਸਰਟੀਫਿਕੇਟ ਜ਼ਰੂਰੀ ਹੈ ਤੁਹਾਡੇ ਡਾਕੂਮੈਂਟ ਜ਼ਰੂਰੀ ਹਨ ਅਤੇ ਇੱਕ ਕਿ ਤੁਸੀਂ ਪੰਜਾਬ ਦੇ ਨਾਗਰਿਕ ਹੋਣਾ ਬਹੁਤ ਜ਼ਰੂਰੀ ਹੈ ਕਈ ਲੋਕ ਜਿਹੜੇ ਸ਼ਡਿਊਲ ਕਾਸਟ ਹੁੰਦੇ ਹਨ ਉਹਨਾਂ ਲਈ ਇੱਕ ਸ਼ਡਿਊਲ ਕਾਸਟ ਦਾ ਸਰਟੀਫਿਕੇਟ ਵੀ ਨਾਲ ਲੱਗਣਾ ਬਹੁਤ ਜ਼ਰੂਰੀ ਹੈ